ਹੈਲੋ ਤੁਸੀਂ ਏ ਬੀ ਸੀ ਬੈਂਕ ਤੋਂ ਗੱਲ ਕਰ ਰਹੇ ਓਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਥੋੜ੍ਹੇ ਦਿਨ ਪਹਿਲਾਂ ਹੀ ਤੁਹਾਡੇ ਪਟਿਆਲੇ ਵਾਲੀ ਬ੍ਰਾਂਚ ਏ ਬੀ ਸੀ ਬੈਂਕ ਵਿੱਚ ਚੈੱਕ ਬੁੱਕ ਕਰਨ ਚੈੱਕ ਬੁੱਕ ਅਪਲਾਈ ਕਰਨ ਵਾਸਤੇ ਆਇਆ ਸੀ ਪਹਿਲਾਂ ਤਾਂ ਮੈਂ ਇਹ ਦਸ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਮੈਂ ਚੈੱਕ ਬੁੱਕ ਅਪਲਾਈ ਕਰਨ ਵਾਸਤੇ ਆਇਆ ਉੱਥੇ ਪਹਿਲਾਂ ਮੈਨੂੰ ਲੰਬੀਆਂ ਕਤਾਰਾਂ ਵਿੱਚ ਖੜ੍ਹਾ ਹੋਣਾ ਪਿਆ ਬਹੁਤ ਹੀ ਗਰਮੀ ਸੀ ਜਿਸ ਕਰਕੇ ਮੈਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਬਾਚੋਂ ਜਦੋਂ ਮੇਰਾ ਨੰਬਰ ਆਇਆ ਉਸ ਟਾਈਮ ਤੁਹਾਡਾ ਇਮਪਲੋਈ ਉਹਨੇ ਮੇਰੇ ਨਾਲ ਬਹੁਤ ਹੀ ਖਰਾਬ ਲਹਿਜ਼ੇ ਨਾਲ ਗੱਲ ਕੀਤੀ ਅਤੇ ਮੈਨੂੰ ਇਵੇਂ ਲੱਗਾ ਕਿ ਜਿਵੇਂ ਮੇਰਾ ਟਾਈਮ ਬਹੁਤ ਹੀ ਖਰਾਬ ਹੋ ਗਿਆ ਟਾਈਮ ਵਿਅਰਥ ਜਾ ਰਿਹਾ ਹੁੰਦਾ ਮੇਰਾ ਉਸਨੇ ਮੇਰੇ ਨਾਲ ਬਹੁਤ ਹੀ ਖਰਾਬ ਲਹਿਜ਼ੇ ਨਾਲ ਗੱਲ ਕੀਤੀ ਹਾਂਜੀ ਮੈਂ ਉਸ ਦਿਨ ਪੰਜ ਨੰਬਰ ਕਾਊਂਟਰ 'ਤੇ ਲਾਈਨ ਵਿੱਚ ਖੜ੍ਹਾ ਸੀ ਉੱਥੇ ਤੁਹਾਡੇ ਅੰਪਲਾਈ ਦੇ ਬੈਚ ਦੇ ਉੱਤੇ ਰਾਹੁਲ ਨਾਮ ਲਿਖਿਆ ਹੋਇਆ ਸੀ ਮੈਂ ਉਸ ਤੋਂ ਬਹੁਤ ਹੀ ਜ਼ਿਆਦਾ ਨਿਰਾਸ਼ਾਜਨਕ ਹਾਂ

ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਸ਼ਾਇਦ ਉਸ ਦਿਨ ਮੈਂ ਵੀ ਕੰਮ ਕਰਕੇ ਜਲਦੀ ਵਿੱਚ ਸੀ ਤਾਂ ਕਰਕੇ ਮੈਨੂੰ ਜ਼ਿਆਦਾ ਫ੍ਰਾਸਟੇਸ਼ਨ ਹੋਈ ਇਸ ਕਰਕੇ ਮੈਂ ਮੈਂ ਆਸ਼ਾ ਕਰਦਾ ਹਾਂ ਕਿ ਥੋ ਤੁਸੀਂ ਆਪਣੀ ਪੋਲਸੀਆਂ ਵਿੱਚ ਬਦਲਾਵ ਲਿਆਵੋਂਗੇ ਅਤੇ ਵਧੀਆ ਕੰਮ ਕਰੋਗੇ ਤਾਂ ਜੋ ਮੇਰੇ ਤਰ੍ਹਾਂ ਕਿਸੇ ਹੋਰ ਕਿਸੇ ਹੋਰ ਬੰਦੇ ਨੂੰ ਐਵੇਂ ਐਵੇਂ ਦੀ ਬਿਹੇਵੀਅਰ ਨਾਲ ਨਾ ਸਾਹਮਣਾ ਕਰਨਾ ਪਵੇ ਠੀਕ ਹੈ ਜੀ ਠੀਕ ਠੀਕ ਹੈ ਜੀ ਧੰਨਵਾਦ